ਵੈਸੇ ਤਾਂ ਮੈਂ ਸਮਝਦਾ ਹਾਂ ਕਿ ਬੱਚਿਆਂ ਲਈ ਡਰਾਇੰਗ ਜਾਂ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਉਮਰ ਕੋਈ ਵੀ ਹੋ ਸਕਦੀ ਹੈ ਪਰ ਜੋ ਅਸਲ ਉਮਰ ਹੈ ਉਹ ਬਚਪਨ ਹੈ ਜਿਸ ਵਿੱਚ ਬੱਚੇ ਦੀ ਉਮਰ ਘੱਟੋ ਘੱਟ ਪੰਜ ਸਾਲ ਤੋਂ ਸ਼ੁਰੂ ਹੁੰਦੀ ਹੈ ਇਸ ਤੋਂ ਬਿਨਾਂ ਜਦੋਂ ਉਹ ਵੱਧ ਉਮਰ ਦਾ ਹੋ ਜਾਵੇ ਤਾਂ ਉਸਨੂੰ ਸੁਚਾਰੂ ਢੰਗ ਨਾਲ ਡਰਾਇੰਗ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ ਕਿਉਂਕਿ ਬਚਪਨ ਦੀ ਉਮਰ ਇਹ ਉਮਰ ਹੁੰਦੀ ਹੈ ਜਿਸ ਵਿੱਚ ਅਸੀਂ ਬੱਚੇ ਦੀ ਕਲਾ ਨੂੰ ਕਿਸੇ ਪਾਸੇ ਵੀ ਲਿਆ ਸਕਦੇ ਹਾਂ